ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਆ ਵੀਰ ਜੀ ਮੈਂ ਥੋੜ੍ਹਾ ਇੱਧਰ ਬਸਤੀ ਬਦੋਵਾਲ ਸਾਈਡ ਤੋਂ ਬੋਲਦਾ ਪਿਆ ਜੀ ਬਸਤੀ ਬਦੋਵਾਲ ਵਾਲੀ ਸਾਈਡ ਤੋਂ ਬੋਲਦਾ ਪਿਆ ਮੈਂ ਨਾ ਮੇਰੀ ਸਿਹਤ ਥੋੜ੍ਹੀ ਨਾ ਜ਼ਿਆਦਾ ਉਹ ਖ਼ਰਾਬ ਜਿਹੀ ਆਈ ਮਤਲਬ ਪਤਲਾ ਜਿਹਾ ਹੀ ਬਹੁਤ ਜ਼ਿਆਦਾ ਹੈਗਾ ਮੈਂ ਅਤੇ ਮੈਨੂੰ ਤੁਹਾਡਾ ਨੰਬਰ ਮੇਰੇ ਫਰੈਂਡ ਤੋਂ ਮਿਲਿਆ ਸੀਗਾ ਕਿ ਤੁਸੀਂ ਵਧੀਆ ਜਿੰਮ ਜਿੰਮ ਵਗੈਰਾ ਕਰ ਦਿੰਦੇ ਹਾਂ ਅਤੇ ਉਹ ਤੁਸੀਂ ਡਾਈਟ ਵਗੈਰਾ ਵਧੀਆ ਦੱਸ ਦਿੰਦੇ ਹੈਗੇ ਆ ਅਤੇ ਇਹ ਫਿਟਨੈਸ ਬਹੁਤ ਤੁਸੀਂ ਬਣਾ ਵਧੀਆ ਬਣਾ ਦਿੰਦੇ ਹੈਗੇ ਆ ਅਤੇ ਮੈਨੂੰ ਦੱਸੋ ਕਿ ਇਹਦਾ ਮੈਂ ਵੀ ਬਣਾਉਣੇ ਆਪਣੇ ਅਤੇ ਤ ਤੁਸੀਂ ਮੈਨੂੰ ਕੁਛ ਐਡਵਾਈਜ਼ ਦੇ ਦਿਓ ਜਾ ਜਾਣਕਾਰੀ ਦੇ ਦਿਓ ਮੈਨੂੰ ਇਸ ਚੀਜ਼ ਦੇ ਵਿੱਚ ਮਾਗ ਮਾਰਗਦਰਸ਼ਨ ਕਰ ਦਿਓ ਮੇਰਾ ਬਾਈ ਮੇਰੀ ਹਾਈਟ ਹੈਗੀ ਆ ਪੰਜ ਫੁੱਟ ਅੱਠ ਇੰਚ ਅਤੇ ਵੇਟ ਹੈਗਾ ਮੇਰਾ ਪਚਵੰਜਾ ਕਿਲੋ ਕਿੱਦਾਂ ਮਤਲਬ ਮੇਰੀ ਮੇਰੀ ਹਾ ਮੇਰੀ ਹਾਈਟ ਹੈਗੀ ਪੰਜ ਫੁੱਟ ਅੱਠ ਇੰਚ ਅਤੇ ਵੇਟ ਹੈਗਾ ਮੇਰਾ ਪਚਵੰਜਾ ਕਿਲੋ ਫਿਫਟੀ ਫਾਈਵ ਕੇਜੀਸ ਉਹ ਥੋੜ੍ਹਾ ਹੁਣ ਹੈਗਾ ਤੁਹਾਨੂੰ ਕਿਹਾ ਤਾਂ ਹੈਗਾ ਪਤਲਾ ਹੈਗਾ ਮੈਂ ਚਲੋ ਦੱਸੋ ਫਿਰ ਕੀ ਚਾਹੀਦਾ ਹਾਂਜੀ ਵੀਰ ਜੀ ਮੈਂ ਸ਼ਾਮੀਂ ਆ ਸਕਦਾ ਹਾਂ ਕੋਈ ਸਵੇਰੇ ਅਤੇ ਜਾਂ ਸ਼ਾਮ ਤੱਕ ਤਾਂ ਮੈਂ ਕਾਲਜ ਹੁੰਦਾ ਹਾਂ ਅਤੇ ਛੇ ਜਾਂ ਸੱਤ ਵਜੇ ਤੱਕ ਆ ਸਕਦਾ ਕੋਲਜ ਮੈਂ ਸੱਤ ਤੋਂ ਨੌਂ ਲਾ ਸਕਦਾ ਮੈਂ ਕਾਡੀਓ ਠੀਕ ਹੈ ਅਤੇ ਕਾਡੀਓ ਵੀ ਵੀਰ ਜੀ ਮੈਨੂੰ ਦੱਸ ਦਿਓ ਕਾਡੀਓ ਹੁੰਦਾ ਕੀ ਮੈਨੂੰ ਕਾਡੀਓ ਪਤਾ ਨਹੀਂ ਮੈਨੂੰ ਤਾਂ ਵੀ ਕਾਡੀਓ ਹੁੰਦਾ ਕੀ ਆ ਓਕੇ ਅਤੇ ਕਾਡੀਓ ਤੋਂ ਬਾਅਦ ਹੋਰ ਉਹ ਤੋਂ ਬਾਅਦ ਹੋਰ ਕੁਛ ਕਰਾਓਂਗੇ ਮੈਨੂੰ ਕਿ ਕਾਡੀਓ ਤੋਂ ਬਾਅਦ ਤੁਸੀਂ ਮੈਨੂੰ ਡਾਇਟ ਦੱਸ ਦਿਓ ਕਿਹੜੀ ਕਿਹੜੀ ਲੈ ਮੈਂ ਤਿੰਨ ਟਾਈਮ ਰੋਟੀ ਖਾ ਲੈਂਦਾ ਹੈਗਾ ਹਾਂ ਅਤੇ ਕਦੀ ਕਦੀ ਰਾਹ 'ਚ ਜਾਂ ਬਾਹਰਲਾ ਘੱਟ ਹੀ ਖਾਂਦਾ ਮਤਲਬ ਮੈਂ ਫਰੂਟਸ ਵਗੈਰਾ ਮੈਂ ਸਾਰੇ ਫਰੂਟਸ ਖਾ ਲੈਂਦਾ ਵੈਸੇ ਤਾਂ ਮੈਂ ਮੈਂ ਉੱਠ ਜਾਂਦਾ ਕੁਛ ਸਾਢੇ ਕੁ ਪੰਜ ਵਜੇ ਨਹੀਂ ਸਾਢੇ ਛੇ ਹਾਂ ਸਾਢੇ ਛੇ ਵਜੇ ਉੱਠ ਜਾਂਦਾ ਮੈਂ ਠੀਕ ਹੈ ਵੋਕਿੰਗ ਕਰਨੀ ਆ ਮਾਰਨਿੰਗ ਜੋਗਿੰਗ ਮਤਲਬ ਜੋਗਿੰਗ ਟਾਈਪ ਅੱਛਾ ਠੀਕ ਹੈ

ਹਾਂ ਹਾਂ ਮੇਰਾ ਬ੍ਰੇਕ ਟਾਈਮ ਤਾਂ ਹੁੰਦਾ ਹੈ ਬਰੇਕ ਟਾਈਮ ਰੋਟੀ ਖਾਂਦੇ ਹੁੰਦੇ ਆਪਾਂ ਕੀ ਖਾਣਾ ਸਪਰਾਊਟ ਕੀ ਹੁੰਦਾ ਵੀਰ ਜੀ ਅੱਛਾ ਚਨੇ ਆ ਚਨੇ ਠੀਕ ਹੈ ਅੱਛਾ ਠੀਕ ਹੈ ਭੁੰਨੇ ਹੋਏ ਚਨੇ ਖਾਣੇ ਆ ਠੀਕ ਹੈ

ਹਾਂ ਹਾਂਜੀ ਸੁਣ ਰਿਹਾ ਹਾਂ ਹਾਂਜੀ ਖਾ ਤਾਂ ਲਈ ਦਾ ਆ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਜਿਮ ਵਗੈਰਾ ਹੈ ਕਿੱਥੇ ਮੈਨੂੰ ਦੱਸ ਦੋਂਗੇ ਜਰਾ ਚਲੋ ਠੀਕ ਆ ਮੈਂ ਤੁਹਾਨੂੰ ਮੈਂ ਤੁਹਾਨੂੰ ਤੁਹਾਨੂੰ ਕਾਲ ਕਰਕੇ ਤੁਹਾਡਾ ਦੁਬਾਰਾ ਅਡਰੈਸ ਲੈ ਲੁੰਗਾ ਮੈਂ ਠੀਕ ਹੈ ਧੰਨਵਾਦ ਬਾਈ